ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਅਮਨ ਬੁਟੀਕ ਤੋਂ ਬੋਲ ਰਹੇ ਜੀ ਹਾਂਜੀ ਜ਼ਰੂਰ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਠੀਕ ਹੈ ਜੀ ਕਿੰਨੇ ਕ ਸੂਟ ਹੋ ਜਾਣਗੇ ਜੀ ਤੁਹਾਡੇ ਠੀਕ ਹੈ ਜੀ ਅਤੇ ਤੁਸੀਂ ਕਿੱਦਾਂ ਦੇ ਸੂਟ ਡਿਜ਼ਾਇਨ ਕਰਵਾਉਣੇ ਨੇ ਸਲਵਾਰ ਸਿੰਪਲ ਸਲਵਾਰ ਸੂਟ ਬਣਵਾਉਣੇ ਆ ਜਾਂ ਜੀ ਨਵੇਂ ਟਰੈਂਡਿੰਗ ਦੇ ਅਕੋਰਡਿੰਗ ਪੈਨਟਸ ਬਣਵਾਉਣੀਆਂ ਨੇ ਠੀਕ ਹੈ ਜੀ ਅਤੇ ਕਦ ਤੱਕ ਚਾਹੀਦੇ ਆ ਜੀ ਕਦੋਂ ਤੱਕ ਚਾਹੀਦੇ ਨੇ ਤੁਹਾਨੂੰ ਸੂਟ ਠੀਕ ਹੈ ਜੀ ਅਸੀਂ ਪੂਰੀ ਟਰਾਈ ਕਰਾਂਗੇ ਕਿ ਤੁਹਾਡੇ ਸੂਟ ਅਸੀਂ ਤੁਹਾਨੂੰ ਟਾਈਮ 'ਤੇ ਦੇ ਦਈਏ ਠੀਕ ਹੈ ਜੀ ਨਹੀਂ ਨਹੀਂ ਜੀ ਅਸੀਂ ਤਾਂ ਬਣਾਉਣ ਤੋਂ ਪਹਿਲਾਂ ਨਾ ਜੀ ਤੁਹਾਨੂੰ ਟਰਾਈ ਕਰਵਾਵਾਂਗੇ ਮਤਲਬ ਕੀ ਹਾਂ ਅਸੀਂ ਅੱਧਾ ਬਣਾ ਕੇ ਪਹਿਲਾਂ ਟਰਾਈ ਕਰਵਾਉਂਦੇ ਹਾਂ ਕਿ ਸਾਨੂੰ ਮਤਲਬ ਕੀ ਬਾਅਦ 'ਚ ਕੋਈ ਦਿੱਕਤ ਨਾ ਆਵੇ ਅਤੇ ਅੱਜ ਤੱਕ ਤਾਂ ਸਾਡੀ ਕੋਈ ਇੱਦਾਂ ਦੀ ਕੰਪਲੇਂਟ ਆਈ ਨਹੀਂ ਹਾਂਜੀ ਹਾਂਜੀ ਹਾਂਜੀ ਸਾਰੇ ਤਰ੍ਹਾਂ ਦਾ ਸਾਡੇ ਇੱਥੇ ਡਿਜ਼ਾਇਨਿੰਗ ਵਗੈਰਾ ਹੁੰਦੀ ਹੈ ਅਤੇ ਜੇ ਕਸਟਮਰ ਦੀ ਕੋਈ ਪਰਸਨਲ ਚੋਇਸ ਹੋਵੇ ਅਸੀਂ ਉੱਦਾਂ ਦੇ ਵੀ ਸੂਟ ਉਹਨਾਂ ਨੂੰ ਡਿਜ਼ਾਇਨ ਕਰਕੇ ਦੇ ਦਿੰਦੇ ਹਾਂ ਅਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਦਾਂ ਦੀ ਕੋਈ ਤੁਹਾਨੂੰ ਪਰੇਸ਼ਾਨੀ ਨਹੀਂ ਆਏਗੀ ਤੁਸੀਂ ਸਾਨੂੰ ਜਸਟ ਸੂਟ ਦੇਣੇ ਆ ਅਤੇ ਅਸੀਂ ਤੁਹਾਨੂੰ ਨਹੀਂ ਨਹੀਂ ਸਾਡੇ ਇੱਦਾਂ ਦੀ ਜੀ ਕੋਈ ਸ਼ਿਕਾਇਤ ਨਹੀਂ ਆਉਂਦੀ ਹੈ ਤੁਸੀਂ ਇੱਕ ਵਾਰੀ ਸਾਡੇ ਤੋਂ ਬਣਵਾ ਕੇ ਦੇਖੋ ਸੂਟ ਅਤੇ ਫਿਰ ਅਸੀਂ ਹਾਂਜੀ ਹਾਂਜੀ ਹਾਂਜੀ ਅਗਰ ਅਗਰ ਤੁਸੀਂ ਸਿੰਪਲ ਸੂਟ ਸਵਾਉਣਾ ਤਾਂ ਸਾਡੇ ਕੋਲ ਅੱਠ ਸੌ ਰੁਪਏ 'ਚ ਸਿੰਪਲ ਸੂਟ ਆ ਅਸੀਂ ਬਣਾਉਂਦੇ ਆ ਅਗਰ ਲੋਨ ਲਵਾਉਣੀ ਆ ਸਲਵਾਰ 'ਤੇ ਕਮੀਜ਼ 'ਤੇ ਅਤੇ ਫਿਰ ਸਿਲਾਈ ਡਬਲ ਹੋ ਜਾਂਦੀ ਹੈ ਫਿਰ ਅਸੀਂ ਸਿਕਸਟੀਨ ਹੰਡਰਡ ਸੌਲ੍ਹਾਂ ਸੌ ਰੁਪਇਆ ਅਸੀਂ ਪਰ ਸੂਟ ਲੈਂਦੇ ਹਾਂ ਜੀ ਅਗਰ ਤੁਸੀਂ ਵਰਕ ਕਰਵਾਉਣਾ ਉੱਤੇ ਕੋਈ ਲਾਇਆ ਲਾਇਦਾ ਮਤਲਬ ਕੁਝ ਕਰਵਾਉਣਾ ਡਿਜ਼ਾਇਨਿੰਗ ਵਗੈਰਾ ਕਰਨੀ ਆ ਫਿਰ ਉਹਦੇ ਅਲੱਗ ਚਾਰਜਸ ਪੈਣਗੇ ਤੁਹਾਨੂੰ ਜੀ ਹਾਂਜੀ ਹਾਂਜੀ ਤੁਸੀਂ ਸਾਨੂੰ ਜੀ ਨੌਂ ਤੋਂ ਪੰਜ ਦੇ ਵਿੱਚ ਵਿੱਚ ਜਦੋਂ ਮਰਜ਼ੀ ਸਾਡੇ ਬੁਟੀਕ ਦੇ ਵਿੱਚ ਆ ਸਕਦੇ ਹੋ ਅਤੇ ਨੌਂ ਤੋਂ ਪੰਜ ਹੀ ਸਾਡੀ ਬੁਟੀਕ ਓਪਨ ਹੁੰਦੀ ਆ ਜੀ ਅਤੇ ਸੈਚਰਡੇ ਸੰਡੇ ਸਾਡਾ ਔਫ ਹੁੰਦਾ ਜੀ ਹਾਂਜੀ ਜੀ ਸਾਡੇ ਦੋਨੇ ਹੀ ਹੁੰਦੇ ਨੇ ਜੈਨਸ ਵੀ ਅਤੇ ਲੇਡੀਜ ਵੀ ਅਸੀਂ ਹਾਂਜੀ ਹਾਂਜੀ ਅਸੀਂ ਹਾਂਜੀ ਹਾਂਜੀ ਕੋਈ ਨਹੀਂ ਟਾਈਮ ਦੀ ਕੋਈ ਨਹੀਂ ਨਹੀਂ ਨਹੀਂ ਤੁਹਾਨੂੰ ਅਸੀਂ ਜਿਹੜਾ ਟਾਈਮ ਦਵਾਂਗੇ ਤੁਹਾਨੂੰ ਉਸੇ ਟਾਈਮ 'ਤੇ ਅਸੀਂ ਸੂਟ ਦੇਵਾਂਗੇ ਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਤੁਸੀਂ ਇੱਦਾਂ ਕਰੋ ਤੁਸੀਂ ਫੋਨ 'ਤੇ ਗੱਲਾਂ ਨਹੀਂ ਹੁੰਦੀਆਂ ਜੀ ਸਾਡੀ ਵਿਜਿਟ ਤੁਸੀਂ ਸਾਡੇ ਉੱਥੇ ਕਰੋ ਬੁਟੀਕ 'ਤੇ ਕਰੋ ਅਤੇ ਅਸੀਂ ਤੁਹਾਨੂੰ ਪੂਰਾ ਸੈਟਿਸਫਾਈ ਕਰਾਂਗੇ ਤੇ ਤੁਸੀਂ ਇੱਕ ਵਾਰੀ ਸਾਡੇ ਤੋਂ ਸੂਟ ਸਿਲਾ ਕੇ ਦੇਖੋ ਅਤੇ ਅਸੀਂ ਔਨ ਦਾ ਟਾਈਮ ਤੁਹਾਨੂੰ ਜਿਹੜੇ ਟਾਈਮ 'ਤੇ ਅਸੀਂ ਕਿਹਾ ਤੁਹਾਨੂੰ ਓਸੇ ਟਾਈਮ 'ਤੇ ਤੁਹਾਨੂੰ ਸੂਟ ਮਿਲ ਜਾਣਗੇ ਜੀ ਇਹ ਬੁਟੀਕ ਹੈ ਜੀ ਸਾਡੀ ਆਈਟੀਆਈ ਰੋਡ 'ਤੇ ਪੈਂਦੀ ਹੈਗੀ ਨੀਅਰ ਜਨਤਾ ਬੇਕਰੀ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਸਾਡੇ ਅਤੇ ਹਾਂ ਤੁਸੀਂ ਸਾਡੀ ਬੁਟੀਕ 'ਤੇ ਆ ਸਕਦੇ ਹੋ ਜੀ ਠੀਕ ਹੈ ਜੀ ਮੈਮ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਮ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਇੱਦਾਂ ਦੀ ਕੋਈ ਗੱਲ ਨਹੀਂ ਹੈ ਤੁਸੀਂ ਜਦ ਮਰਜ਼ੀ ਸਾਨੂੰ ਤੁਸੀਂ ਸੂਟ ਦੇ ਕੇ ਜਾ ਸਕਦੇ ਹਾਂਜੀ ਓਕੇ ਜੀ ਮੈਮ ਥੈਂਕ ਯੂ